ਬਾਰਾਂ ਫਰਵਰੀ ਦੋ ਹਜ਼ਾਰ ਪੰਜ ਤਿੰਨ ਮਾਰਚ ਦੋ ਹਜ਼ਾਰ ਦਸ ਛੇ ਜੂਨ ਉੱਨੀ ਸੌ ਚੁਰਾਨਵੇਂ ਪੰਦਰਾਂ ਅਗਸਤ ਉੱਨੀ ਸੌ ਚੌਂਹਠ ਸੱਤ ਦਸੰਬਰ ਉੱਨੀ ਸੌ ਤ੍ਰਿਆਨਵੇਂ